ਖੂਹ ਵਿੱਚੋਂ ਪਾਣੀ ਕੱਢਣ ਦੇ ਕਈ ਤਰੀਕੇ ਹਨ ਜਦੋਂ ਸਾਡਾ ਮੇਰਾ ਬਚਪਨ ਸੀਗਾ ਜੋ ਮੈਂ ਦੇਖਿਆ ਹੈ ਨੋਰਮਲ ਜਿਹਾ ਇੱਕ ਕਿਉਂਕਿ ਪਾਣੀ ਦਾ ਪੱਧਰ ਕਾਫੀ ਉੱਚਾ ਹੁੰਦਾ ਸੀਗਾ ਇੱਕ ਟੋਆ ਪੁੱਟਦੇ ਸੀਗੇ ਉਸ ਟੋਏ 'ਚੋਂ ਕੋਈ ਪੰਜ ਸੱਤ ਫੁੱਟ ਡੂੰਘਾ ਟੋਆ ਪੁੱਟਦੇ ਸੀ ਉਹਦੇ ਵਿੱਚੋਂ ਹੱਥ ਨਾਲ ਜਿਹੜਾ ਪਾਣੀ ਆਰਾਮ ਨਾਲ ਅਸੀਂ ਬਾਹਰ ਕੱਢ ਸਕਦੇ ਸੀਗੇ ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਦਾ ਪੱਧਰ ਵਰਤੋਂ ਦੇ ਨਾਲ ਨੀਵਾਂ ਹੋ ਗਿਆ ਥੋੜ੍ਹਾ ਜਿਹਾ ਕੋਈ ਜ਼ਿਆਦਾ ਨਹੀਂ ਫਿਰ ਬਲਦਾਂ ਅਤੇ ਹਲਟ ਅਤੇ ਟਿੰਡਾਂ ਦਾ ਜਿਹੜਾ ਸੀਗਾ ਵਰਤੋਂ ਨਾਲ ਜਿਹੜੇ ਲੋਕ ਸੀਗੇ ਪਾਣੀ ਧਰਤੀ ਦੇ ਵਿੱਚੋਂ ਕੱਢਦੇ ਸੀਗੇ ਜਿਹੜੇ ਹਲਟ ਸੀਗੇ ਅਤੇ ਟਿੰਡਾਂ ਸੀ ਇਹਨਾਂ ਨੂੰ ਬਲਦ ਘੁੰਮਾਉਂਦੇ ਸੀਗੇ ਅਤੇ ਉਹ ਫਿਰ ਪਾਣੀ ਜਿਹੜਾ ਖੂਹ ਵਿੱਚੋਂ ਇੱਕ ਚਵੱਚੇ ਦੇ ਵਿੱਚ ਇਕੱਠਾ ਕਰ ਲੈਂਦੇ ਸੀ ਉਸ ਨੂੰ ਫਿਰ ਅੱਗੋਂ ਅੱਗੇ ਵਰਤ ਲਿਆ ਜਾਂਦਾ ਸੀ ਜੇ ਖੇਤਾਂ ਨੂੰ ਦੇਣਾ ਤਾਂ ਖਾਲ਼ਾਂ ਦੇ ਰਾਹੀਂ ਭੇਜਿਆ ਜਾਂਦਾ ਸੀ ਜੇ ਕਿਸੇ ਨੇ ਵੈਸੇ ਘਰ ਦੀ ਵਰਤੋਂ ਲਈ ਵਰਤਣਾ ਹੈ ਤਾਂ ਪਾਣੀ ਜਿਹੜਾ ਹੈ ਉਹ ਬਾਲਟੀਆਂ ਜਾਂ ਹੋਰ ਕਿਸੇ ਬਰਤਨ ਦੀ ਮਦਦ ਨਾਲ ਭਰ ਲਿਆ ਜਾਂਦਾ ਸੀਗਾ ਉਸ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਮਨੁੱਖ ਨੇ ਮਾਨਵਤਾ ਨੇ ਤਰੱਕੀ ਕੀਤੀ ਤਾਂ ਫਿਰ ਘਿਰਨੀ ਲੱਜ ਅਤੇ ਮਸ਼ਕ ਦਾ ਯੁੱਗ ਆ ਗਿਆ ਉਹਦੇ ਵਿੱਚ ਫਿਰ ਅਸੀਂ ਘਿਰਨੀ ਇੱਕ ਜਿਹੜੀ ਕਿ ਇੱਕ ਸਿੰਪਲ ਮਸ਼ੀਨ ਹੈ ਉਹਦੇ ਰਾਹੀਂ ਲੱਜ ਰਾਹੀਂ ਥੱਲੇ ਮਸ਼ਕ ਜਾਂ ਕੋਈ ਬਾਲਟੀ ਵਗੈਰਾ ਜਾਂ ਕੋਈ ਹੋਰ ਬਰਤਨ ਨਾਲ ਬੰਨ ਕੇ ਪਾਣ ਵਿੱਚ ਖੂਹ ਵਿੱਚੋਂ ਪਾਣੀ ਕੱਢ ਲੈਂਦੇ ਸੀਗੇ ਅਤੇ ਉਸ ਤੋਂ ਬਾਅਦ ਜਿਹੜਾ ਫਿਰ ਯੁੱਗ ਆਇਆ ਪਾਣੀ ਤਾਂ ਥੋੜ੍ਹਾ ਜਿਹਾ ਹੋਰ ਨੀਵਾਂ ਹੋ ਗਿਆ ਅਤੇ ਬੋਰ ਕਰਕੇ ਨਲਕੇ ਨਾਲ ਨਲਕੇ ਦੀ ਸਹਾਇਤਾ ਨਾਲ ਮਸ਼ੀਨ ਦੀ ਸਹਾਇਤਾ ਨਾਲ ਅਸੀਂ ਪਾਣੀ ਜਿਹੜਾ ਬਾਹਰ ਕੱਢਣ ਲੱਗ ਪਏ ਉਸ ਤੋਂ ਬਾਅਦ ਫਿਰ ਪਾਣੀ ਦਾ ਪੱਧਰ ਜਿਹੜਾ ਹੋਰ ਨੀਵਾਂ ਹੁੰਦਾ ਗਿਆ ਇਸ ਤਰ੍ਹਾਂ ਵਰਤੋਂ ਕਰਨ ਨਾਲ ਫਿਰ ਇੰਜਣਾਂ ਦੀ ਸਹਾਇਤਾ ਨਾਲ ਜਿਹੜਾ ਪਾਣੀ ਹੈ ਉਹ ਬਾਹਰ ਕੱਢਿਆ ਜਾਂਦਾ ਇੰਜਣ ਅਤੇ ਪੱਖੇ ਦੀ ਸਹਾਇਤਾ ਨਾਲ ਪਾਣੀ ਬਾਹਰ ਕੱਢਿਆ ਜਾਂਦਾ ਇੰਜਣ ਜ਼ਿਆਦਾਤਰ ਜਿਹੜੇ ਸਲੋਅ ਸਪੀਡ ਹੁੰਦੇ ਸੀਗੇ ਜਿਹੜੇ ਜਾ ਕੇ ਜਿਵੇਂ ਕਿ ਅਸੀਂ ਦੇਖੇ ਨੇ ਦੋ ਵੀਲਸ ਵਾਲੇ ਲਿਸਟਰ ਇੰਜਣ ਕਹਿੰਦੇ ਸੀ ਉਸ ਤੋਂ ਬਾਅਦ ਲਿਸਟਰ ਜਿਹੜਾ ਸੀ ਤੇਲ ਦੀ ਖਪਤ ਵੀ ਘੱਟ ਕਰਦਾ ਸੀ ਸ਼ੋਰ ਵੀ ਜਿਹੜਾ ਆਵਾਜ਼ ਦਾ ਸ਼ੋਰ ਆ ਬਹੁਤ ਘੱਟ ਹੁੰਦਾ ਸੀ ਇਹਨਾਂ ਦਾ ਅਤੇ ਫਿਰ ਥੋੜ੍ਹਾ ਜਿਹਾ ਯੁੱਗ 'ਚ ਹੋਰ ਚੇਂਜ ਹੋਇਆ ਫਿਰ ਇਹਦੀ ਜਗ੍ਹਾ 'ਤੇ ਖਪਤ ਇਸ ਤੋਂ ਵੀ ਘਟਾਉਣ ਵਾਸਤੇ ਡੀਜ਼ਲ ਦੀ ਫਿਰ ਅਸੀਂ ਜਿਹੜਾ ਦੇਖਿਆ ਜੋ ਪੀਟਰ ਇੰਜਣ ਆ ਗਏ ਅਤੇ ਪਰ ਪੀਟਰ ਇੰਜਣ ਦਾ ਇੱਕ ਨੁਕਸਾਨ ਸੀ ਇਹ ਆਵਾਜ਼ ਦਾ ਜਿਹੜਾ ਸ਼ੋਰ ਆ ਬਹੁਤ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਹੋਰ ਨਵਾਂ ਯੁੱਗ ਆ ਗਿਆ ਬਿਜਲੀ ਜਦੋਂ ਆ ਗਈ ਪੰਜਾਬ ਦੇ ਵਿੱਚ ਸੱਤਰ ਪਝੱਤਰ ਦੇ ਨੇੜੇ ਤੇੜੇ ਦੀ ਜੋ ਅਸੀਂ ਸੁਣਦੇ ਹਾਂ ਬਜ਼ੁਰਗਾਂ ਤੋਂ ਫਿਰ ਪੱਖੇ ਨਾਲ ਇੰਜਣ ਦੀ ਜਗ੍ਹਾ 'ਤੇ ਮੋਟਰ ਨੇ ਥਾਂ ਲੈ ਲਈ ਬਿਜਲੀ ਵਾਲੀ ਮੋਟਰ ਨੇ ਉਹਦੇ ਨਾਲ ਫਿਰ ਪਾਣੀ ਅਸੀਂ ਕੱਢਣ ਲੱਗ ਪਏ ਫਿਰ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਗਿਆ ਵਰਤੋਂ ਨਾਲ ਅਤੇ ਫਿਰ ਖੂਹੀਆਂ ਪੁੱਟ ਕੇ ਉਹਦੇ ਵਿੱਚ ਮੋਟਰ 'ਤੇ ਮੋਨੋਬਲੋਕ ਜਿਹੜੇ ਪੱਖਾ ਲੱਗਣ ਲੱਗ ਪਿਆ ਪਾਣੀ ਫਿਰ ਉਹਦੇ ਨਾਲ ਅਸੀਂ ਕੱਢਦੇ ਰਹੇ ਪਾਣੀ ਦਾ ਜਿਹੜਾ ਪੱਧਰ ਵਰਤੋਂ ਨਾਲ ਲਗਾਤਾਰ ਵਰਤੋਂ ਨਾਲ ਪਾਣੀ ਦੀ ਫਿਰ ਹੋਰ ਪੱਧਰ ਨੀਵਾਂ ਹੋ ਗਿਆ ਅਤੇ ਜੋ ਅੱਜ ਕੱਲ੍ਹ ਦਾ ਸਮਾਂ ਹੈ ਅੱਜ ਕੱਲ੍ਹ ਸਮਰਸੀਬਲ ਮੋਟਰ ਹੁਣ ਅੱਜ ਕਲ੍ਹ ਜਿਹੜੀ ਚੱਲ ਰਹੀ ਹੈ ਸਮਰਸੀ ਮੋਟਰ ਨਾਲ ਅਸੀਂ ਪਾਣੀ ਬਾਹਰ ਕੱਢਦੇ ਹਾਂ ਇਸ ਤਰ੍ਹਾਂ ਇਹੀ ਜਿਹੜਾ ਤਰੀਕਾ ਅਸੀਂ ਜੋ ਦੇਖਿਆ ਹੈ ਜਾਂ ਸੁਣਿਆ ਹੈ ਇਹੀ ਅਸੀਂ ਵਰਤੇ ਨੇ ਅਤੇ ਹੋਰ ਵੀ ਅਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਟੈਕਨੋਲਜੀ ਅੱਗੇ ਐਡਵਾਂਸ ਹੁੰਦੀ ਜਾਵੇਗੀ ਵਰਤੋਂ ਕਰਦੇ ਰਵਾਂਗੇ